ਇੰਝ ਤਾਂ ਪੰਜਾਬ ਵਿੱਚ ਕਈ ਕਲਾ ਅਤੇ ਕਈ ਸ਼ਿਲਪਕਾਰੀਆਂ ਹਨ ਕਈ ਸ਼ਿਲਪਕਾਰੀਆਂ ਹਾਸਾ ਹਸਾਉਣ ਖੁਸ਼ੀਆਂ ਖੇਡ ਵਾਲੀਆਂ ਹੁੰਦੀਆਂ ਹਨ ਪਰ ਕਈ ਸ਼ਿਲਪਕਾਰੀਆਂ ਰੋਣ ਰਵਾਉਣ ਵਾਲੀ ਦੁਖੀ ਮਨ ਵਾਲੀਆਂ ਵੀ ਹੁੰਦੀਆਂ ਹਨ ਹਾਸਾ ਹਸਾਉਣ ਵਾਲੀ ਸ਼ਿਲਪਕਾਰੀਆਂ ਜਿਵੇਂ ਕਿ ਵਿਆਹ ਕਿਸੇ ਦੇ ਘਰ ਬੱਚਾ ਜੰਮਣਾ ਆਦੀਆਂ ਖੁਸ਼ੀਆਂ ਵਾਲੀਆਂ ਹੁੰਦੀਆਂ ਹਨ ਇਹ ਸ਼ਿਲਪਕਾਰੀਆਂ ਵਿੱਚ ਬਥੇਰੀਆਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਸ ਦੀ ਹਰ ਇੱਕ ਰਸਮ ਵਿੱਚ ਖੁਸ਼ੀ ਅਤੇ ਪਿਆਰ ਅਤੇ ਭਾਈਚਾਰਾ ਸਾਫ਼ ਸਾਫ਼ ਦਿਸਦਾ ਹੈ ਪਰ ਕਈ ਅਜਿਹੀਆਂ ਸ਼ਿਲਪਕਾਰੀਆਂ ਵੀ ਹੁੰਦੀਆਂ ਹਨ ਜੋ ਦੁਖੀਆਂ ਅਤੇ ਰੋਣ ਭਾਵੁਕ ਅਤੇ ਰੋਣ ਭਾਵੁਕ ਹੁੰਦੀਆਂ ਹਨ ਉਹ ਸ਼ਿਲਪਕਾਰੀਆਂ ਮਰਦਾਂ ਵਾਲੀ ਸ਼ਿਲਪਕਾਰੀਆਂ ਹੁੰਦੀਆਂ ਹਨ ਜਿਸ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਅਤੇ ਮੌਤ ਇੱਕ ਰੱਬ ਦਾ ਲਿਖਿਆ ਹੋਇਆ ਐਸੀ ਚੀਜ਼ ਹੈ ਜਿਸਨੂੰ ਕਦੇ ਵੀ ਕੋਈ ਮੋੜ ਨਹੀਂ ਸਕਦਾ ਅਤੇ ਅਤੇ ਇਹ ਸ਼ਿਲਪਕਾਰੀਆਂ ਵਿੱਚ ਵੀ ਕਈ ਰਸਮਾਂ ਭੁਗਤਾਈਆਂ ਜਾਂਦੀਆਂ ਨੇ ਜੋ ਹਰ ਇੱਕ ਰਸਮ ਨਾਲ਼ ਦੁੱਖ ਅਤੇ ਰੋਣ ਭਾਵੁਕ ਪ੍ਰਗਟ ਕਰਦਾ ਹੈ ਇਹ ਸ਼ਿਲਪਕਾਰੀਆਂ ਵਿੱਚ ਬਥੇਰੀਆਂ ਸ਼ਿਲਪਕਾਰੀਆਂ ਹਨ ਜੋ ਖੁਸ਼ੀਆਂ ਰੋਣਾ ਦੁੱਖ ਸੁੱਖ ਵੰਡਦਾ ਹੈ ਇਹ ਸ਼ਿਲਪਕਾਰੀਆਂ ਲੋਕਾਂ ਦੇ ਵਿੱਚ ਭਾਈਚਾਰਾ ਵਧਾਉਂਦਾ ਹੈ ਪਿਆਰ ਵਧਾਉਂਦਾ ਹੈ ਚਾਹੇ ਇਹ ਸ਼ਿਲਪਕਾਰੀਆਂ ਖੁਸ਼ੀਆਂ ਭਰੀਆਂ ਹੋਣ ਜਾਂ ਦੁੱਖ ਭਰੀਆਂ ਹੋਣ